ਮੈਂ ਪ੍ਰੇਮ ਸਿੰਘ ਵਾਸੀ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹੈਂਡ ਪੰਪ ਕਿਵੇਂ ਕੰਮ ਕਰਦਾ ਹੈ ਹੈਂਡ ਪੰਪ ਜੋ ਕਿ ਇੱਕ ਤਰ੍ਹਾਂ ਦਾ ਨਲਕਾ ਜਾਂ ਪਾਈਪ ਦੇ ਵਿੱਚ ਇੱਕ ਬੋਕੀ ਦੀ ਤਰ੍ਹਾਂ ਕੰਮ ਕਰਦਾ ਹੈ ਬੋਕੀ ਉਹ ਹੁੰਦੀ ਹੈ ਜਿਹੜੀ ਕਿ ਸਾਨੂੰ ਆਪਣੇ ਅਕਰ ਓ ਖਿੱਚਣ ਦੇ ਵਿੱਚ ਸਾਡੀ ਮਦਦ ਕਰਦੀ ਹੈ ਜੋ ਕਿ ਲੰਬੀਆਂ ਲੰਬੀਆਂ ਪਾਈਪਾਂ ਅਤੇ ਉਹਨਾਂ ਦੇ ਵਿੱਚ ਇਹ ਪਾਣੀ ਖਿੱਚ ਕੇ ਬਾਹਰ ਨੂੰ ਕੱਢਣਾ ਹੁੰਦਾ ਹੈ ਕਿ ਪੰਪ ਦੀ ਜ਼ਰੀਆ ਨਾਲ ਜੋ ਗਰਮੀਆਂ ਦੇ ਵਿੱਚ ਇਹ ਪੰਪ ਜਿਹੜਾ ਹੈ ਖੁਸ਼ਕ ਹੋ ਜਾਂਦਾ ਹੈ ਜਿਸ ਦੇ ਕਾਰਨ ਕਿ ਪਾਣੀ ਜਿਹੜਾ ਥੱਲੇ